ਜੀ ਹਾਂਜੀ ਸਾਨੂੰ ਪਾਣੀ ਸਪਲਾਈ ਮਿਲਦੀ ਹੈ ਇਹ ਪਾਣੀ ਪੀਣ ਯੋਗ ਹੁੰਦਾ ਹੈ ਸਵੇਰੇ ਚਾਰ ਤੋਂ ਅੱਠ ਅਤੇ ਸ਼ਾਮ ਨੂੰ ਤਿੰਨ ਤੋਂ ਪੰਜ ਵਜੇ ਤੱਕ ਪਾਣੀ ਆਉਂਦਾ ਹੈ ਅਸੀਂ ਆਪਣੇ ਘਰ ਦੇ ਹਰ ਕੰਮ ਲਈ ਪਾਣੀ ਵਰਤਦੇ ਹਾਂ ਅਤੇ ਕੱਪੜੇ ਧੋਣਾ ਅਤੇ ਸਫਾਈ ਕਰਨ ਲਈ ਇਹ ਪਾਣੀ ਵਰਤਦੇ ਹਾਂ ਜੇਕਰ ਇਹ ਪਾਣੀ ਨਾ ਆਵੇ ਤਾਂ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਾਣੀ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ ਅਤੇ ਜੇਕਰ ਇਹ ਪਾਣੀ ਨਾ ਆਵੇ ਤਾਂ ਸਾਡੇ ਕੋਲ ਸਰਕਾਰੀ ਪਾਣੀ ਸਪਲਾਈ ਤੋਂ ਇਲਾਵਾ ਪੀਣ ਯੋਗ ਪਾਣੀ ਦਾ ਕੋਈ ਵੀ ਸ੍ਰੋਤ ਨਹੀਂ ਹੈ ਸੋ ਪਾਣੀ ਦੀ ਸਪਲਾਈ ਸਾਡੇ ਲਈ ਬਹੁਤ ਜ਼ਰੂਰੀ ਹੈ